ਭੰਗੜਾ ਸਾਡਾ ਲੋਕ ਨਾਚ ਹੈ ਅਤੇ ਐਰੋਬਿਕਸ ਇੱਕ ਐਕਸਰਸਾਈਜ਼ ਦੀ ਹੀ ਇੱਕ ਫੋਰਮ ਹੈ ਅਤੇ ਜਦੋਂ ਭੰਗੜਾ 'ਤੇ ਆਰੋਬਿਕਸ ਨੂੰ ਆਪਸ 'ਚ ਮਿਲਾਇਆ ਜਾਂਦਾ ਹੈ ਅਤੇ ਜਦੋਂ ਕੋਰਿਓਗ੍ਰਾਫੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਗੀਤ ਚੁਣਦੇ ਹਾਂ ਭਾਵੇਂ ਉਹ ਪੰਜਾਬੀ ਹੋਵੇ ਪੰਜਾਬੀ ਹੀ ਗੀਤ ਚੁਣਦੇ ਹਾਂ ਕਿਉਂਕਿ ਉੱਤੇ ਭੰਗੜਾ ਜ਼ਿਆਦਾ ਵਧੀਆ ਪੈਂਦਾ ਹੈ ਅਤੇ ਫਿਰ ਭੰਗੜੇ ਦੇ ਐਕਸ਼ਨਸ ਨੂੰ ਅਸੀਂ ਉਸ ਗਾਣੇ ਦੇ ਨਾਲ ਤੇ ਐਰੋਬਿਕਸ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਸਪੀਡ ਦਾ ਥੋੜ੍ਹਾ ਫਰਕ ਪੈਂਦਾ ਹੈ ਕਿਉਂਕਿ ਐਰੋਬਿਕਸ ਅਤੇ ਭੰਗੜਾ ਦੋਨਾਂ ਦੇ ਵਿੱਚ ਹੀ ਆਪਾਂ ਨੂੰ ਇਕ ਤਰ੍ਹਾਂ ਦੀ ਐਕਸਰਸਾਈਜ਼ ਬੌਡੀ ਦੀ ਹੋ ਜਾਂਦੀ ਹੈ ਅਤੇ ਆਪਣਾ ਬਾਕੀ ਪੰਜਾਬੀ ਗਾਣੇ ਸੁਣ ਕੇ ਤਾਂ ਮਨ ਉੱਦਾਂ ਹੀ ਆਪਣੇ ਆਪ ਸਾਡੇ ਕਦਮ ਨੱਚਣ ਨੂੰ ਕਰਦੇ ਨੇ ਅਤੇ ਫੇਰ ਸਭ ਤੋਂ ਪਹਿਲਾਂ ਅਸੀਂ ਭੰਗੜੇ ਦੇ ਐਕਸ਼ਨਸ ਨੂੰ ਉਸ ਗਾਣੇ ਦੇ ਵਿੱਚ ਕਰਦੇ ਹਾਂ ਅਤੇ ਫਿਰ ਹੌਲੀ ਹੌਲੀ ਕਰਕੇ ਇੱਕ ਇੱਕ ਸਟੈਪ ਸਟੈਪ ਕਰਕੇ ਫਿਰ ਅਸੀਂ ਐਰੋਬਿਕਸ 'ਤੇ ਗਾਣਾ ਤਿਆਰ ਕਰ ਲੈਂਦੇ ਹਾਂ ਕੋਈ ਇੰਨਾਂ ਔਖਾ ਨਹੀਂ ਪਰ ਮਜ਼ਾ ਬਹੁਤ ਆਉਂਦਾ ਹੈ ਜਦੋਂ ਆਪਾਂ ਭੰਗੜਾ ਅਤੇ ਐਰੋਬਿਕਸ ਨੂੰ ਆਪਸ 'ਚ ਦੋਨਾਂ ਦਾ ਮੇਲ ਕਰਾਉਂਦੇ ਹਾਂ ਤਾਂ ਇੱਕ ਵੱਖਰਾ ਹੀ ਭੰਗੜੇ ਦੀ ਆਪਣੀ ਆਪਣਾ ਨਾਚ ਅਤੇ ਐਰੋਬਿਕਸ ਦੀ ਜਿਹੜੀ ਹੈਗੀ ਆਪਣੀ ਜਿਹੜੀ ਐਨਰਜੀ ਹੁੰਦੀ ਹੈ ਇਹ ਦੋਨੋਂ ਮਿਲ ਕੇ ਹੋਰ ਜ਼ਿਆਦਾ ਉਹਨਾਂ ਬੋਡੀ ਨੂੰ ਐਨਰਜੈਟਿਕ ਦਿੰਦੇ ਹਨ ਧੰਨਵਾਦ ਸਹਿਤ